ਪੰਜਾਬ ਵਿੱਚ ਮਿਲ ਰਹੀਆਂ ਖ਼ਬਰਾਂ ਵਿੱਚ ਰੁਝਾਨ ਜਿਹੜਾ ਹੈਗਾ ਸਭ ਤੋਂ ਵੱਧ ਇਹ ਹੈਗਾ ਕਿ ਟੈਕਨੋਲੋਜੀ ਜਿਹੜੀ ਹੈਗੀ ਆ ਹਰ ਖੇਤਰ ਵਿੱਚ ਛਾਈ ਹੋਈ ਹੈ ਜਿਵੇਂ ਕਿ ਅੱਜ ਕੱਲ੍ਹ ਖਬਰਾਂ ਹਰ ਤਰ੍ਹਾਂ ਦੇ ਸਾਧਨਾਂ ਤੇ ਉਪਲੱਬਧ ਨੇ ਜਿਵੇਂ ਫੋਰ ਇੰਗਜ਼ਾਪਲ ਜਿਹੜਾ ਉਦਾਹਰਣ ਦੇ ਤੌਰ 'ਤੇ ਪਹਿਲਾਂ ਅਖਬਾਰਾਂ ਜਾਂ ਰੇਡੀਓ 'ਤੇ ਹੀ ਖ਼ਬਰਾਂ ਮਿਲਦੀਆਂ ਸੀ ਅੱਜ ਕੱਲ੍ਹ ਟੈਲੀਵਿਜ਼ਨ ਯੂਟਿਊਬ ਚੈਨਲਾਂ 'ਤੇ ਵੀ ਖਬਰਾਂ ਮਿਲਦੀਆਂ ਨੇ ਹਰ ਬੰਦੇ ਦੇ ਮੋਬਾਇਲ ਮੁੱਠੀ ਵਿੱਚ ਹੈ ਪੂਰਾ ਸੰਸਾਰ ਇੰਟਰਨੈੱਟ ਦੇ ਥਰੂ ਹਰ ਬੰਦੇ ਦੀ ਮੁੱਠੀ ਵਿੱਚ ਹੈ ਅਸੀਂ ਜਦੋਂ ਵੀ ਚਾਹੀਏ ਜਿਸ ਸ ਥਾਂ 'ਤੇ ਵੀ ਚਾਹੀਏ ਕਿਸੇ ਵੀ ਤਰ੍ਹਾਂ ਦੀ ਸੂਚਨਾ ਜਾਂ ਖਬਰ ਪਤਾ ਕਰ ਸਕਦੇ ਹਾਂ ਖਬਰਾਂ ਦੇ ਵਿੱਚ ਆਮ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਸਮੋਇਆ ਜਾਂਦਾ ਹੈ ਪਰ ਜ਼ਿਆਦਾਤਰ ਖਬਰਾਂ ਜਿਹੜੀਆਂ ਪੰਜਾਬ ਵਿੱਚੋਂ ਆ ਰਹੀਆਂ ਨੇ ਉਹਨਾਂ ਵਿੱਚ ਵਿਸ਼ਵੀਕਰਨ ਦਾ ਮੁੱਦਾ ਕਾਫੀ ਭਾਰੂ ਰਹਿੰਦਾ ਹੈ ਕਿਉਂਕਿ ਜਿਹੜੇ ਵੀ ਪੰਜਾਬ ਦੀ ਜ਼ਿਆਦਾਤਰ ਜਿਹੜੀ ਮੌਜੂਦਾ ਪੀੜ੍ਹੀ ਹੈਗੀ ਆ ਉਹ ਬਾਹਰ ਵੱਲ ਜ਼ਿਆਦਾ ਭੱਜ ਰਹੀ ਹੈ ਜਾਂ ਬਾਹਰ ਵੱਲ ਜ਼ਿਆਦਾ ਪ੍ਰਵਾਸ ਕਰ ਰਹੀ ਹੈ ਜਿਵੇਂ ਕਿ ਪੰਜਾਬ ਵਿੱਚੋਂ ਲੱਖਾਂ ਵਿਦਿਆਰਥੀ ਜਾਂ ਲੱਖਾਂ ਹੋਰ ਲੋਕ ਜਿਹੜੇ ਹੈਗੇ ਨੇ ਪੰਜਾਬ ਛੱਡ ਕੇ ਕੈਨੇਡਾ ਨੂੰ ਭੱਜ ਰਹੇ ਨੇ ਜਾਂ ਪ੍ਰਵਾਸ ਕਰ ਰਹੇ ਨੇ ਇਹ ਖਬਰਾਂ ਵੀ ਮੁੱਦਾ ਬਣਦੀਆਂ ਨੇ ਅਤੇ ਹਰ ਚੈਨਲ ਇੱਦਾਂ ਦੀਆਂ ਖਬਰਾਂ ਮੁਹੱਈਆ ਜਾਂ ਪ੍ਰਸਾਰਿਤ ਕਰਦਾ ਰਹਿੰਦਾ ਹੈ